ਸਾਡੇ ਪਿੰਡ ਵਿੱਚ ਜਾਂ ਸਾਡੇ ਪੰਜਾਬ ਵਿੱਚ ਗਿੱਧੇ ਨੂੰ ਬਹੁਤ ਹੀ ਮਹਾਨਤਾ ਦਿੱਤੀ ਗਈ ਹੈ ਲੋਕ ਗਿੱਧੇ ਜਾਂ ਭੰਗੜੇ ਨੂੰ ਬਹੁਤ ਹੀ ਚਾਅ ਨਾਲ ਬਹੁਤ ਹੀ ਚਾਅ ਅਤੇ ਵਧੀਆ ਢੰਗ ਨਾਲ ਪਾਉਂਦੇ ਹਨ ਜਦੋਂ ਮੇਰੇ ਸਕੂਲ ਵਿੱਚ ਕੋਈ ਵੀ ਫੰਕਸ਼ਨ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ ਮੈਂ ਉਸ ਵਿੱਚ ਪਾਰਟੀਸਪੇਟ ਜ਼ਰੂਰ ਕਰਦੀ ਹਾਂ ਮੈਨੂੰ ਡਾਂਸ ਕਰਨ ਦਾ ਬਹੁਤ ਸ਼ੌਂਕ ਹੈ ਮੈਂ ਹਰ ਇੱਕ ਸ਼ੋਅ ਵਿੱਚ ਹਰ ਇੱਕ ਕਿਸੇ ਵੀ ਚੀਜ਼ 'ਤੇ ਪਾਰਟੀਸਪੇਟ ਕਰਦੀ ਹਾਂ ਮੈਂ ਮ ਮੈਂ ਹਰ ਇੱਕ ਸ਼ੋਅ ਵਿੱਚ ਪਾਰਟੀਸਪੇਟ ਕਰਦੀ ਹਾਂ ਸਾਡੇ ਮੇਰੇ ਮੇਰੇ ਸ ਇਸ ਸਮਾਜ ਵਿੱਚ ਲੋਕ ਗਿੱਧੇ ਨੂੰ ਬਹੁਤ ਹੀ ਮਹਾਨਤਾ ਦਿੰਦੇ ਹਨ ਕੋਈ ਵੀ ਵਿਆਹ ਹੁੰਦਾ ਹੈ ਜਾਂ ਕੋਈ ਕੋਈ ਵੀ ਵਿਆਹ ਹੁੰਦਾ ਹੈ ਤਾਂ ਉੱਥੇ ਡ ਡੀ ਜੇ ਚੱਲਦੇ ਹਨ ਲੋਕ ਮੁੰਡੇ ਭੰਗੜਾ ਪਾਉਂਦੇ ਹਨ ਅਤੇ ਕੁੜੀਆਂ ਭੰਗੜਾ ਪਾਉਂਦੀਆਂ ਹਨ ਅਤੇ ਜੋ ਕਿ ਬਜ਼ੁਰਗ ਆਂਟੀਆਂ ਹੁੰਦੀਆਂ ਹਨ ਉਹ ਬੋਲੀਆਂ ਪਾ ਪਾ ਕੇ ਭੰਗੜਾ ਪਾਉਂਦੀਆਂ ਹਨ ਬਹੁਤ ਭੰਗੜੇ ਪਾਉਂਦੇ ਹਨ ਮੁੰਡੇ ਮੁੰਡੇ ਬਹੁਤ ਹੀ ਵਧੀਆ ਢੰਗ ਨਾਲ ਭੰਗੜੇ ਪਾਉਂਦੇ ਹਨ ਅਤੇ ਉਹ ਪੰਜਾਬੀ ਸੱਭਿਆਚਾਰ ਨਾਲ ਬਹੁਤ ਹੀ ਪ੍ਰਭਾਵਿਤ ਹੁੰਦੇ ਹਨ ਬਹੁਤ ਲੋ ਇਸ ਤਰ੍ਹਾਂ ਲੋਕ ਭੰਗੜੇ ਦਾ ਇਸ ਤਰ੍ਹਾਂ ਲੋਕ ਭੰਗੜੇ ਦਾ ਆਨੰਦ ਮਾਣਦੇ ਹਨ